ਡਰਾਇੰਗ ਦਾ ਤਾਂ ਜਿਵੇਂ ਬਚਪਨ ਤੋਂ ਹੀ ਮੇਰੇ ਅੰਦਰ ਕੀੜਾ ਸੀ ਅਤੇ ਇੱਕ ਦਿਨ ਮੈਂ ਆਪਣੇ ਪਾਪਾ ਜੀ ਨਾਲ ਕਿਸੇ ਅ ਮਿਊਜ਼ੀਅਮ 'ਤੇ ਚਲਾ ਗਿਆ ਉੱਥੇ ਅਲੱਗ ਅਲੱਗ ਪ੍ਰਕਾਰ ਦੇ ਚਿੱਤਰ ਦੇਖ ਕੇ ਡਰਾਇੰਗਾਂ ਦੇਖ ਕੇ ਲੋਕਾਂ ਨੇ ਪੇਸ਼ਕਸ਼ ਦਿਖਾਈ ਸੀ ਉੱਥੇ ਕਿਸੇ ਨੇ ਝਰਨੇ ਦੀ ਬਣਾਈ ਸੀ ਕਿਸੇ ਨੇ ਮਾਂ ਬਾਪ ਦੀ ਬਣਾਈ ਸੀ ਕਿਸੇ ਨੇ ਕੋਈ ਕੁੜੀ ਸਿਲਾਈ ਸੀ ਰਹੀ ਹੈ ਉਸਦੀ ਬਣਾਈ ਸੀ ਅਲੱਗ ਅਲੱਗ ਪ੍ਰਕਾਰ ਦੀਆਂ ਪੇਂਟਿੰਗਾਂ ਬਣਾਈਆਂ ਸਨ ਉੱਥੇ ਅਤੇ ਸਾਡੇ ਸਕੂਲ ਵੀ ਜਦੋਂ ਕੋਈ ਵੀ ਕੋਂਪਟੀਸ਼ਨ ਹੁੰਦਾ ਸੀ ਅਤੇ ਸਾਡੇ ਦੋਸਤ ਮਿੱਤਰ ਅਲੱਗ ਅਲੱਗ ਪ੍ਰਕਾਰ ਦੀਆਂ ਪੇਂਟਿੰਗਾਂ ਬਣਾਉਂਦੇ ਸਨ ਅਤੇ ਉਹਨਾਂ ਨੂੰ ਵੱਲ ਦੇਖ ਕੇ ਮੈਂ ਵੀ ਬਹੁਤ ਪ੍ਰਭਾਵਿਤ ਹੁੰਦਾ ਸੀ ਸੋ ਇਸੇ ਕਰਕੇ ਮੈਨੂੰ ਇਸ ਚੀਜ਼ ਦਾ ਸ਼ੌਂਕ ਪੈ ਸ਼ੌਂਕ ਵੀ ਪੈ ਗਿਆ ਜਿਸ ਨਾਲ ਕਿ ਮੈਨੂੰ ਡਰਾਇੰਗ ਦਾ ਬਹੁਤ ਜ਼ਿਆਦਾ ਸੌਂਕ ਹੈ ਡਰਾਇੰਗ ਬਣਾਉਣ ਦਾ ਅਤੇ ਮੈਂ ਉਸ ਦਿਨ ਤੋਂ ਹੀ ਡਰਾਇੰਗ ਕੋਈ ਨਾ ਕੋਈ ਬਣਾਉਂਦਾ ਰਿਹਾ ਅਤੇ ਇੱਦਾਂ ਹੀ ਬਣਾ ਬਣਾ ਕੇ ਮੈਂ ਤੀਹ ਪੈਂਤੀ ਪੇਜ ਭਰ ਦਿੱਤੇ ਜਿਨਾਂ ਵਿੱਚੋਂ ਪੇਜ ਨੰਬਰ ਬਾਰਾਂ ਵਾਲਾ ਚਿੱਤਰ ਮੇਰਾ ਬਹੁਤ ਵਧੀਆ ਸੀ ਜੋ ਮੇਰੇ ਮਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਉਹ ਮੈਂ ਬਣਾਈ ਸੀ ਇੱਕ ਸ਼ਿਵ ਜੀ ਭਗਵਾਨ ਦੀ ਤਸਵੀਰ ਬਣਾਈ ਸੀ ਜਿਹਦੇ ਵਿੱਚ ਮੂਰਤੀ ਬਣਾਉਂਦਿਆ ਬਣਾਉਂਦਿਆਂ ਨੂੰ ਮੈਨੂੰ ਬਹੁਤ ਤੰਗੀ ਆਈ ਸੀ ਅਤੇ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਉਸ ਨੂੰ ਪੂਰਾ ਕੀਤਾ ਅਤੇ ਲੋਕਾਂ ਨੂੰ ਜਦੋਂ ਦਿਖਾਇਆ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮਾਪੇ ਨੂੰ ਗਾਹਕਾਂ ਨੂੰ ਜਦੋਂ ਉਹਨਾਂ ਅੱਗੇ ਲੈ ਕੇ ਗਿਆ ਦਿਖਾਇਆ ਅਤੇ ਉਹਨਾਂ ਨੇ ਸ਼ੁਰੂ ਤੋਂ ਤੂੰ ਕਿਹਾ ਕਿ ਨਹੀਂ ਮਤਲਬ ਤੁਹਾਨੂੰ ਥੋੜ੍ਹੀ ਪ੍ਰੈਕਟਿਸ ਦੀ ਲੋੜ ਹੈ ਹੋਰ ਅਤੇ ਚਲੋ ਉਸ ਨੂੰ ਮੱਦੇ ਰਸਨ ਨਜ਼ਰ ਰੱਖਦੇ ਹੋਏ ਮੈਂ ਫਿਰ ਤੋਂ ਇੱਕ ਸ਼ਿਵ ਜੀ ਭਗਵਾਨ ਦੀ ਮੂਰਤੀ ਬਣਾਈ ਜਿਹੜੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਉਸ ਵਿੱਚ ਮੈਂ ਪੈਂਸਿਲ ਦਾ ਵਰਕ ਕੀਤਾ ਸੀ ਸਕੈੱਚ ਦਾ ਵਰਕ ਕੀਤਾ ਸੀ ਪੇਂਟ ਵਾਲੇ ਕਲਰ ਦਾ ਵ ਵਰਕ ਕੀਤਾ ਸੀ ਵਾਟਰ ਕਲਰ ਯੂਜ ਕੀਤੇ ਸੀ ਸਾਰਿਆਂ ਨੂੰ ਮਿਲਾ ਮਲੂ ਕੇ ਬਣਾਈ ਉਹ ਜਿਹੜਾ ਤਜਰਬਾ ਸੀ ਜਦੋਂ ਲੋਕਾਂ ਨੇ ਮੈਨੂੰ ਤਾੜੀਆਂ ਮਾਰੀਆਂ ਮੇਰੇ ਵਾਸਤੇ ਉਹ ਬਹੁਤ ਹੀ ਮਜੇਦਾਰ ਸੀ ਉਸ ਦਿਨ ਤੋਂ ਬਾਅਦ ਫਿਰ ਮੇਰੀਆਂ ਅੱਜ ਹੁਣ ਲੱਖਾਂ 'ਚ ਪੇਂਟਿੰਗਾਂ ਵਿਕਦੀਆਂ ਹਨ